ਸਤਿ ਸ਼੍ਰੀ ਅਕਾਲ ਜੀ ਗੁਰੂ ਕਿਰਪਾ ਟਰੈਵਲਿੰਗ ਏਜੰਸੀ ਤੋਂ ਬੋਲ ਰਹੇ ਹਾਂ ਦਰਅਸਲ 'ਚ ਮੈਂ ਪਰਸੋਂ ਅੰਮ੍ਰਿਤਸਰ ਗਈ ਸੀ ਜਿਸ ਲਈ ਮੈਂ ਤੁਹਾਡੀ ਏਜੰਸੀ ਤੋਂ ਇੱਕ ਗੱਡੀ ਬੁੱਕ ਕਰਵਾਈ ਸੀ ਉਹ ਗੱਡੀ ਦਾ ਸਫਰ ਮੇਰਾ ਬਹੁਤ ਵਧੀਆ ਰਿਹਾ ਡਰਾਈਵਰ ਨੇ ਮੈਨੂੰ ਸਮੇਂ ਤੋਂ ਪਹਿਲਾਂ ਮੇਰੀ ਮੰਜ਼ਿਲ 'ਤੇ ਪਹੁੰਚਾ ਦਿੱਤਾ ਅਤੇ ਮੇਰਾ ਸਫਰ ਬਹੁਤ ਹੀ ਅਰਾਮਦਾਇਕ ਸੀ ਅੱਜ ਮੈਂ ਦੁਬਾਰਾ ਕਿਸੇ ਜ਼ਰੂਰੀ ਕੰਮ ਕਰਕੇ ਫੇਰ ਅੰਮ੍ਰਿਤਸਰ ਜਾਣਾ ਹੈ ਜਿਸ ਕਰਕੇ ਮੈਨੂੰ ਗੱਡੀ ਦੀ ਜ਼ਰੂਰਤ ਹੈ ਕਿਰਪਾ ਕਰਕੇ ਮੈਨੂੰ ਉਹੀ ਡਰਾਈਵਰ ਅਤੇ ਗੱਡੀ ਦੁਬਾਰਾ ਭੇਜੀ ਜਾਵੇ ਕਿਉਂਕਿ ਮੈਨੂੰ ਉਸ 'ਤੇ ਸਫਰ ਕਰਨਾ ਬਹੁਤ ਹੀ ਵਧੀਆ ਲੱਗਿਆ ਅਤੇ ਮੈਨੂੰ ਸਫਰ ਵਿੱਚ ਕੋਈ ਵੀ ਪਰੇਸ਼ਾਨੀ ਨਹੀਂ ਆਈ ਕਿਰਪਾ ਕਰਕੇ ਮੇਰੀ ਮੇਰਾ ਆਰਡਰ ਬੁੱਕ ਕਰਕੇ ਮੈਨੂੰ ਜਲਦੀ ਤੋਂ ਜਲਦੀ ਗੱਡੀ ਭੇਜੀ ਜਾਵੇ ਧੰਨਵਾਦ